ਮੈਂ ਔਨਲਾਈਨ ਸ਼ਾਪਿੰਗ ਕਰਨ ਦਾ ਸ਼ੌਕੀਨ ਹਾਂ ਜਿਹਦੇ ਵਿੱਚ ਮੈਂ ਜਿਹੜਾ ਉਹਦਾ ਇੱਕ ਪ੍ਰੋਡਕਟ ਮੰਗਵਾਇਆ ਸੀ ਜਿਹੜਾ ਕਿ ਗੀਜ਼ਰ ਸੀ ਪਰ ਔਨਲਾਈਨ ਦਿਖਾਏ ਗਏ ਅਨੁਸਾਰ ਉਹਦੇ ਵਿੱਚ ਓਨੇ ਫੀ ਨਾ ਤਾਂ ਫੀਚਰ ਸੀ ਨਾ ਹੀ ਉਸਦੀ ਕੁਆਲਿਟੀ ਸੀ ਅਤੇ ਉਹ ਪੰਜ ਜਾਂ ਦਸ ਦਿਨਾਂ ਦੇ ਵਿੱਚ ਹੀ ਸਿਰਫ ਪਾਣੀ ਗਰਮ ਕੀਤਾ ਇਸ ਤੋਂ ਬਾਅਦ ਉਹ ਜਿਹੜਾ ਉਹ ਖਰਾਬ ਹੋ ਗਿਆ ਅਤੇ ਇੱਦੂ ਬਾਅਦ ਉਸ ਦੇ ਉੱਤੇ ਅਸੀਂ ਰਿਪੇਅਰ ਵੀ ਕਰਵਾਈ ਪਰ ਉਸਨੇ ਫਿਰ ਉਸਦਾ ਕੋਈ ਕੰਮ ਨਹੀਂ ਕੀਤਾ ਜੇਕਰ ਅਸੀਂ ਕੰਪਨੀ ਦੇ ਵਿੱਚ ਦੁਬਾਰਾ ਕੰਪਲੇਂਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਵੀ ਕੋਈ ਹੱਲ ਨਾ ਨਿਕਲਿਆ ਤਾਂ ਮੇਰਾ ਇਹ ਜਿਹੜਾ ਉਸਨੂੰ ਮੈਂ ਜਿਹੜੇ ਇਸ ਤਰੀਕੇ ਨਾਲ ਕਹਿ ਸਕਦਾ ਵੀ ਉਹ ਜਿਹੜਾ ਮੰਗਵਾਇਆ ਗਿਆ ਮੇਰਾ ਪ੍ਰੋਡਕਟ ਸੀ ਉਹ ਬਹੁਤ ਹੀ ਘਟੀਆ ਕੁਆਲਟੀ ਦਾ ਰਿਹਾ ਜਿਹਦੇ ਵਿੱਚ ਮੈਨੂੰ ਕੋਈ ਬੈਨੀਫਿਟ ਨਾ ਹੋ ਸਕਿਆ